ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਦਰ ਸਮੇਂ ਦੀ ਕਰਦੀ ਹਾਂ ਸਮੇਂ ਬਾਰੇ ਕਿਹਾ ਜਾਂਦਾ ਹੈ ਕਿ ਜੇ ਇੱਕ ਵਾਰੀ ਸਮਾਂ ਲੰਘ ਜਾਵੇ ਤਾਂ ਉਹ ਕਦੇ ਵੀ ਮੁੜ ਕੇ ਨਹੀਂ ਆਉਂਦਾ ਕਿਹਾ ਜਾਂਦਾ ਇੱਕ ਕਹਾਵਤ ਵੀ ਹੈ ਕਿ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ ਜੋ ਕਿ ਸਮੇਂ ਦੇ ਨਾਲ ਹੀ ਸੰਬੰਧਿਤ ਹੈ ਇਸ ਕਰਕੇ ਮੈਂ ਆਪਣੇ ਸਮੇਂ ਨੂੰ ਕਦੇ ਵੀ ਅਜਾਈਂ ਨਹੀਂ ਗਵਾਉਂਦੀ ਮੈਂ ਹਮੇਸ਼ਾ ਆਪਣੇ ਸਮੇਂ ਨੂੰ ਚੰਗੇ ਕੰਮਾਂ ਦੇ ਵਿੱਚ ਲਗਾਉਂਦੀ ਹਾਂ ਜਿਵੇਂ ਕਿ ਮੈਨੂੰ ਪੜ੍ਹਨਾ ਅਤੇ ਲਿਖਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਆਪਣੇ ਵਿਹਲੇ ਸਮੇਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪੁਸਤਕਾਂ ਪੜ੍ਹਦੀ ਹਾਂ ਜੋ ਕਿ ਮੇਰੇ ਗਿਆਨ ਦੇ ਵਿੱਚ ਵਾਧਾ ਕਰਦੀਆਂ ਨੇ ਆਪਣੇ ਗਿਆਨ ਨੂੰ ਵਧਾਉਣ ਦੇ ਲਈ ਮੈਂ ਹਮੇਸ਼ਾ ਚੰਗੀਆਂ ਪੁਸਤਕਾਂ ਪੜ੍ਹਦੀ ਰਹਿੰਦੀ ਹਾਂ ਤਾਂ ਕਿ ਮੈਂ ਆਪਣਾ ਗਿਆਨ ਵੱਧ ਤੋਂ ਵੱਧ ਹੋਰ ਵਧਾ ਸਕਾਂ ਅਤੇ ਇਸ ਤੋਂ ਬਿਨਾਂ ਮੈਨੂੰ ਲਿਖਣ ਦਾ ਵੀ ਬਹੁਤ ਸ਼ੌਕ ਹੈ ਮੈਂ ਇੱਕ ਲੇਖਕ ਬਣਨ ਦੀ ਚਾਹਵਾਨ ਹਾਂ ਇਸ ਕਰਕੇ ਮੈਂ ਆਪਣੇ ਸਮੇਂ ਨੂੰ ਆਪਣੇ ਉੱਪਰ ਹੀ ਲਗਾਉਂਦੀ ਹਾਂ ਤਾਂ ਕਿ ਅੱਜ ਮੈਂ ਆਪਣੇ ਸਮੇਂ ਨੂੰ ਆਪਣੇ ਉੱਪਰ ਕੀਤੀ ਮਿਹਨਤ ਰਾਹੀਂ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰ ਸਕਾਂ ਮੈਨੂੰ ਪੜ੍ਹਾਉਣ ਦਾ ਵੀ ਬਹੁਤ ਸ਼ੌਕ ਹੈ ਮੈਂ ਇੱਕ ਕਾਲਜ ਦੇ ਵਿੱਚ ਪੜ੍ਹਾਉਂਦੀ ਹਾਂ ਜਿਸ ਦੇ ਰਾਹੀਂ ਮੈਂ ਸਾਹਿਤ ਦੇ ਨਾਲ ਜੁੜੀ ਹੋਈ ਹਾਂ ਸਾਹਿਤ ਪੜ੍ਹਨਾ ਅਤੇ ਪੜ੍ਹਾਉਣਾ ਮੇਰਾ ਮੈਨੂੰ ਬਹੁਤ ਚੰਗਾ ਲੱਗਦਾ ਮੇਰਾ ਪੇਸ਼ਾ ਵੀ ਹੈ ਅਤੇ ਮੇਰਾ ਸ਼ੌਕ ਵੀ ਹੈ ਇਸ ਕਰਕੇ ਮੈਂ ਆਪਣੇ ਸਮੇਂ ਦੀ ਬਹੁਤ ਕਦਰ ਕਰਦੀ ਹਾਂ ਆਪਣੇ ਸਮੇਂ ਦੇ ਵਿੱਚ ਹੀ ਮੈਂ ਕਿੱਧਰੇ ਵੱਖ ਵੱਖ ਥਾਵਾਂ 'ਤੇ ਘੁੰਮਣ ਵੀ ਜਾਂਦੀ ਹਾਂ ਮੈਨੂੰ ਦੂਜੇ ਥਾਵਾਂ 'ਤੇ ਘੁੰਮਣ ਦਾ ਵੀ ਬਹੁਤ ਸ਼ੌਕ ਹੈ ਜਿਸ ਨਾਲ ਮੈਂ ਆਪਣਾ ਗਿਆਨ ਵੀ ਵਧਾਉਂਦੀ ਹਾਂ ਇਸ ਕਰਕੇ ਮੈਨੂੰ ਇਹ ਜਾਪਦਾ ਹੈ ਕਿ ਸਮਾਂ ਹੈ ਜਿਹੜਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੀਮਤੀ ਹੁੰਦਾ ਤੁਸੀਂ ਆਪਣੇ ਸਮੇਂ ਨੂੰ ਜੇਕਰ ਚੰਗੇ ਕੰਮਾਂ ਦੇ ਵਿੱਚ ਲਗਾਉਂਦੇ ਹੋ ਕੁਝ ਚੀਜ਼ਾਂ ਨੂੰ ਸਿੱਖਣ ਦੇ ਵਿੱਚ ਲਗਾਉਂਦੇ ਹੋ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਦੇ ਵੀ ਇਨਸਾਨ ਨੂੰ ਪਛਤਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਵਿਅਕਤੀ ਆਪਣੇ ਸਮੇਂ ਨੂੰ ਅਜਾਈਂ ਗਵਾ ਦਿੰਦੇ ਹਨ ਮੈਂ ਅੰਤ ਦੇ ਵਿੱਚ ਉਹਨਾਂ ਨੂੰ ਪਛਤਾਉਂਦੇ ਹੋਏ ਦੇਖਿਆ ਹੈ